ਹਾਂਜੀ ਬਿਲਕੁਲ ਖੇਡਾਂ ਨੂੰ ਕਿਸੇ ਵੀ ਵਿਅਕਤੀ ਦੇ ਵਿੱਚ ਫਿਜ਼ੀਕਲ ਅਤੇ ਮੈਂਟਲੀ ਪਾਵਰ ਦੇਣ ਲਈ ਆਪਾਂ ਵਰਤ ਸਕਦੇ ਹਾਂ ਕਿਉਂਕਿ ਖੇਡਾਂ ਨਾਲ ਸਾਡਾ ਦਿਮਾਗ ਤੰਦਰੁਸਤ ਰਹਿੰਦਾ ਹੈ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ ਜਦੋਂ ਸਾਡਾ ਦਿਮਾਗ ਅਤੇ ਸਰੀਰ ਤੰਦਰੁਸਤ ਰਹੇਗਾ ਤਾਂ ਉਹ ਇਨਸਾਨ ਦੇ ਵਿੱਚ ਆਪਣੇ ਆਪ ਸੈ ਸਵੈ ਵਿਸ਼ਵਾਸ ਆਤਮ ਵਿਸ਼ਵਾਸ ਪੈਦਾ ਹੋਵੇਗਾ ਕਿਉਂਕਿ ਜਦੋਂ ਸਾਡਾ ਸ਼ਰੀਰ ਫਿੱਟ ਹੋਵੇਗਾ ਸਾਡਾ ਦਿਮਾਗ ਫਿੱਟ ਹੋਵੇਗਾ ਤਾਂ ਅਸੀਂ ਕੁਛ ਵੀ ਕਰ ਸਕਦੇ ਹਾਂ ਅਗਰ ਇਨਸਾਨ ਕੁਛ ਵੀ ਕਰ ਸਕਦਾ ਹੈ ਤਾਂ ਇਟ ਮੀਨ ਉਹਦੇ ਵਿੱਚ ਸਵੈ ਵਿਸ਼ਵਾਸ ਸਵੈਮਾਨਤਾ ਆਪਣੇ ਆਪ ਹੀ ਆ ਜਾਵੇਗਾ ਖੇਡਾਂ ਇਨਸਾਨ ਨੂੰ ਬਹੁਤ ਅੰਦਰੋਂ ਸਟਰੋਂਗ ਬਣਾਉਂਦੀਆਂ ਨੇ ਜਿਹੜਾ ਇਨਸਾਨ ਅੰਦਰੋਂ ਬਹੁਤ ਸਟਰੋਂਗ ਹੋਵੇਗਾ ਤਾਂ ਉਹਦੇ ਵਿੱਚ ਵਿਸ਼ਵਾਸ ਤਾਂ ਕੁੱਟ ਕੁੱਟ ਕੇ ਭਰਿਆ ਹੋਵੇਗਾ ਵਿਸ਼ਵਾਸ ਹੋਵੇਗਾ ਤਾਂ ਉਸ ਇਨਸਾਨ ਨੂੰ ਹੋਵੇਗਾ ਕਿ ਉਹ ਕੋਈ ਵੀ ਕੰਮ ਕਰ ਸਕਦਾ ਆਪਣੇ ਦਮ 'ਤੇ ਇਸ ਕਰਕੇ ਖੇਡਾਂ ਕਿਸੇ ਵੀ ਇਨਸਾਨ ਦੇ ਵਿੱਚ ਸਵੈ ਵਿਸ਼ਵਾਸ ਅਤੇ ਸਵੈ ਮਾਣ ਭਰਨ ਦੇ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਉਂਦੀਆਂ ਹਨ